ਪੰਜਾਬ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਹਨ ਜੋ ਕਿ ਬਾਹਰ ਕਿਤੇ ਨਹੀਂ ਮਿਲਦੀਆਂ ਪੰਜਾਬ 'ਚ ਹੀ ਮਿਲਦੀਆਂ ਹਨ ਜੋ ਸੈਲਾਨੀ ਬਾਹਰੋਂ ਆਉਂਦੇ ਹਨ ਉਹ ਪੰਜਾਬ ਦੀਆਂ ਇਹਨਾਂ ਚੀਜ਼ਾਂ ਕਾਰਨ ਹੀ ਪੰਜਾਬ ਤੋਂ ਆਕਰਸ਼ਨਣ ਹੁੰਦੇ ਹਨ ਜਿੱਦਾਂ ਕਿ ਪੰਜਾਬ ਵਿੱਚ ਕੁਲਚੇ ਹਨ ਜੋ ਕਿ ਪੂਰੇ ਪੰਜਾਬ ਵਿੱਚ ਅੰਮ੍ਰਿਤਸਰ ਮਿਲਦੇ ਆ ਅਤੇ ਪੂਰੇ ਇੰਡੀਆ ਵਿੱਚ ਅੰਮ੍ਰਿਤਸਰ ਹੀ ਮਿਲਦੇ ਹਨ ਇਹ ਕੁਲਚੇ ਕਿਤੇ ਹੋਰ ਨਹੀਂ ਮਿਲਦੇ ਇੱਥੋਂ ਉੱਥੋਂ ਹੀ ਲੋਕ ਸਿੱਖ ਕੇ ਬਾਹਰ ਜਾ ਕੇ ਬਣਾਉਣਾ ਸ਼ੁਰੂ ਕਰਤਾ ਹੈ ਪਰ ਉਹੋ ਜਿਹਾ ਸਵਾਦ ਇਹ ਨਹੀਂ ਬਣਾ ਸਕਦੇ ਸਕੇ ਹਾਲੇ ਤੱਕ ਟੈਕਸਟਾਈਲ ਦੀ ਗੱਲ ਕਰੀਏ ਤਾਂ ਪੂਰੇ ਇੰਡੀਆ ਵਿੱਚ ਸਭ ਤੋਂ ਵੱਡੀ ਟੈਕਸਟਾਈਲ ਇੰਡਸਟਰੀ ਅੰਮ੍ਰਿਤਸਰ ਵਿੱਚ ਹੈ ਅੰਮ੍ਰਿਤਸਰ ਵਿੱਚ ਜਿੰਨੀ ਵੱਡੀ ਟੈਕਸਟਾਈਲ ਇੰਡਸਟਰੀ ਹੈ ਸ਼ਾਇਦ ਹੀ ਪੂਰੇ ਏਸ਼ੀਆ ਵਿੱਚ ਹੋਵੇ ਜਦ ਕਿ ਹੁਣ ਥੋੜ੍ਹੀ ਜਿਹੀ ਟੈਕਸ ਇੰਡਸਟਰੀ ਘੱਟ ਗਈ ਹੈ ਕਿਉਂਕਿ ਰਾਜਨੀਤੀ ਦੇ ਕਾਰਣ ਇਹਨਾਂ ਨੇ ਸ ਇਹ ਪਾਬੰਦੀ ਇਹੋ ਜਿਹੀਆਂ ਲਗਾ ਦਿੱਤੀਆਂ ਹਨ ਕਿ ਇਹ ਇਹਨਾਂ ਨੂੰ ਟੈਕਸ ਬੜਾ ਪੈਂਦਾ ਇਸ ਕਦੇ ਕੁਛ ਇੱਕ ਬੰਦੇ ਆਪਣੀ ਇੰਡਸਟਰੀਆਂ ਬੰਦ ਕਰ ਗਏ ਹਨ ਜਿੱਦਾਂ ਕਿ ਸਰਤਾਜ ਵਾਲੇ ਹੋ ਗਏ ਸਮਰਾਟ ਵਾਲੇ ਹੋ ਗਏ ਪਰ ਹਾਲੇ ਵੀ ਬਹੁਤ ਸਾਰੀਆਂ ਇੰਡਸਟਰੀਆਂ ਇੱਥੇ ਹਨ ਪੰਜਾਬ ਦੇ ਅੰਮ੍ਰਿਤਸਰ ਵਿੱਚ ਬਣਿਆ ਕੱਪੜਾ ਪੂਰੇ ਹਿੰਦੁਸਤਾਨ ਵਿੱਚ ਕੀ ਪੂਰੇ ਏਸ਼ੀਆ ਵਿੱਚ ਜਾਂਦਾ ਹੈ ਅਤੇ ਉੱਥੇ ਲੋਕ ਇਹ ਕੱਪੜਾ ਪਾ ਕੇ ਬੜੇ ਖੁਸ਼ ਹੁੰਦੇ ਹਨ ਜਿੰਨੇ ਵੀ ਬਰਾਂਡ ਹਨ ਵਧੀਆ ਵਧੀਆ ਬਰਾਂਡ ਮਹਿੰਗੇ ਮਹਿੰਗੇ ਬਰਾਂਡ ਉਹ ਸਾਰੇ ਕੱਪੜਾ ਇੱਥੋਂ ਪੰਜਾਬ ਦੀ ਇੰਡਸਟਰੀ ਕੋਲੋਂ ਲੈਂਦੇ ਹਨ ਅਤੇ ਆਪਣੀਆਂ ਮੋਹਰਾਂ ਲਾ ਕੇ ਅੱਗੇ ਵੇਚਦੇ ਹਨ ਕੱਪੜੇ ਤੋਂ ਬਾਅਦ ਟੈਕਸਟਾਈਲ ਤੋਂ ਬਾਅਦ ਅਸੀਂ ਗਹਿਣੇ ਦੀ ਗੱਲ ਕਰੀਏ ਪੰਜਾਬ ਦਾ ਗਹਿਣਾ ਬਹੁਤ ਹੀ ਜ਼ਿਆਦਾ ਵਧੀਆ ਹੈ ਕਿਉਂਕਿ ਪੰਜਾਬ ਦਾ ਪਾਣੀ ਬੜਾ ਅੱਛਾ ਹੈ ਇੱਥੋਂ ਦੇ ਸੁਨਿਆਰੇ ਲੋਕ ਬਾਹਰ ਜਾ ਕੇ ਗਹਿਣਾ ਬਣਾਉਂਦੇ ਹਨ ਪਰ ਉੱਥੇ ਉਹ ਗੱਲ ਨਹੀਂ ਬਣਦੀ ਪ ਉਹ ਲੋਕ ਸੁਨਿਆਰੇ ਲੋਕ ਇੱਥੇ ਹੀ ਗਹਿਣਾ ਤਿਆਰ ਕਰਕੇ ਬਾਹਰ ਜਾ ਕੇ ਵੇਚਦੇ ਹਨ ਉਹ ਜਿੱਦਾਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਸੁਣਿਆ ਇਹ ਲੋਕ 'ਚ ਨੱਬੇ ਪਰਸੈਂਟ ਮਿਲਾਵਟ ਹੁੰਦੀ ਹੈ ਪਰ ਬਾਹਰ ਦੇ ਸੁਨਿਆਰੇ ਜਿਹੜੇ ਬਾਹਰ ਦੇ ਮੁਲ ਸਟੇਟਾਂ ਦੇ ਸੁਨਿਆਰੇ ਉਸ ਮਿਲਾਵਟ ਨੂੰ ਫੜ ਨਹੀਂ ਸਕਦੇ ਕਿਉਂਕਿ ਇਥੋਂ ਦੇ ਪਾਣੀ ਵਿੱਚ ਹੀ ਉਹ ਰੰਗਤ ਹੈ ਹੁਣ ਗੱਲ ਕਰੀਏ ਮਿੱਟੀ ਦੇ ਬਰਤਨਾਂ ਦੀ ਮਿੱਟੀ ਦੇ ਬਰਤਨ ਸਭ ਤੋਂ ਜ਼ਿਆਦਾ ਇੱਥੇ ਹੀ ਬਣਦੇ ਹਨ ਖਾਸ ਤੌਰ 'ਤੇ ਜਿਹਨੂੰ ਅਸੀਂ ਹਿੰਦੀ ਵਿੱਚ ਕਹਿੰਦੇ ਹਾਂ ਚਾਟੀ ਅਸੀਂ ਇੱਥੇ ਪੰਜਾਬੀ 'ਚ ਕਹਿੰਦੇ ਹਾਂ ਘੜਾ ਚਾਟੀ ਦੀ ਲੱਸੀ ਘੜੇ ਦੀ ਲੱਸੀ ਰਿੜਕ ਕੇ ਜਿਹੜੀ ਪੀਂਦੇ ਹਨ ਉਹ ਬਹੁਤ ਹੀ ਵਧੀਆ ਹੁੰਦੀ ਹੈ ਅਤੇ ਜਿਹੜਾ ਘੜਾ ਹੈ ਉਹ ਸਿਰਫ਼ ਅਤੇ ਸਿਰਫ਼ ਪੂਰੇ ਹਿੰਦੂਸਤਾਨ ਵਿੱਚ ਕੀ ਪੂਰੇ ਏਸ਼ੀਆ ਵਿੱਚ ਕੀ ਪੂਰੇ ਸੰਸਾਰ ਵਿੱਚ ਸਿਰਫ਼ ਅੰਮ੍ਰਿਤਸਰ ਵਿੱਚ ਹੀ ਬਣਾਇਆ ਜਾਂਦਾ ਹੈ ਦੂਰੋਂ ਦੂਰੋਂ ਲੋਕ ਇੱਥੇ ਆਉਂਦੇ ਹਨ ਅਤੇ ਮਿੱਟੀ ਦਾ ਘੜਾ ਲੈ ਕੇ ਜਾਂਦੇ ਹਨ ਜਦ ਕਿ ਇਹਨੂੰ ਲੈ ਕੇ ਜਾਣਾ ਕੋਈ ਸੌਖੀ ਗੱਲ ਨਹੀਂ ਹੈ ਅੱਜ ਕੱਲ੍ਹ ਤਾਂ ਇੰਨੇ ਲੋਕੀ ਮਹਿੰਗੇ ਮਹਿੰਗੇ ਅਟੈਚੀ ਲੋਹੇ ਦੇ ਅਟੈਚੀ ਟੁੱਟ ਜਾਂਦੇ ਹਨ ਪਰ ਮਿੱਟੀ ਦਾ ਘੜਾ ਲੈ ਕੇ ਜਾਣਾ ਬੜੀ ਔਖੀ ਗੱਲ ਹੈ ਉਹ ਫਿਰ ਵੀ ਇਹਨੂੰ ਬੜੀ ਆਪਣੀ ਜਿੰਦ ਜਾਨ 'ਤੇ ਰੱਖ ਕੇ ਲੈ ਕੇ ਜਾਂਦੇ ਹਨ